ਹੈਲੋ ਹਾਂਜੀ ਹਾਂਜੀ ਬਈਆ ਗੋਪਾਲ ਸਵੀਟਸ ਤੋਂ ਬੋਲ ਰਹੇ ਹੋ ਹਾਂਜੀ ਬਈਆ ਰਸ ਮਲਾਈ ਆਡਰ ਕਰਨੀ ਸਰ ਸ਼ੁਕਰਵਾਰ ਹੈ ਹਨਾ ਤੁਹਾਡੇ ਸਪੈਸ਼ਲ ਬਣਦੀ ਹੈ ਹਾਂਜੀ ਹਾਂ ਕਾਫੀ ਜਨਿਆ ਤੋਂ ਸੁਣ ਰੱਖਿਆ ਵੀ ਬਹੁਤ ਵਧੀਆ ਬਣਦੀ ਹੈ ਹਾਂਜੀ ਹਾਂਜੀ ਬਈਆ ਨਹੀਂ ਨਹੀਂ ਰਸਮਲਾਈ ਹਾਂਜੀ ਹਾਂਜੀ ਠੀਕ ਹੈ ਜੀ ਪਰਪੀਸ ਦਾ ਰੇਟ ਦੱਸ ਰਿਹਾ ਤੁਸੀਂ ਇਹ ਹਾਂਜੀ ਠੀਕ ਹੈ ਹਾਂਜੀ ਹਾਂ ਡਬਲ ਡਬਲ ਪੀਸ ਕਰਵਾ ਕੇ ਚਾਰ ਪੈਕਿੰਗ ਕਰਵਾ ਦੋ ਹਾਂ ਠੀਕ ਹੈ ਜੀ ਕਿੰਨੇ ਕ ਟਾਈਮ ਤੱਕ ਆਜੂਗੀ ਠੀਕ ਹੈ ਮੈਂ ਤੁਹਾਨੂੰ ਐਡਰੈਸ ਸੈਂਡ ਕਰਦੀ ਹੈਗੀ ਤੁਸੀਂ ਮੰਗਵਾ ਦੋ ਮਤਲਬ ਭੇਜ ਦਿਓ ਔਰ ਅਸੀਂ ਪੇਮੈਂਟ ਕੈਸ਼ ਓਨ ਡਿਲੀਵਰੀ ਕਰੀਏ ਕਿ ਆਨਲਾਈਨ ਕਰਾਂ ਮੈਂ ਤੁਹਾਨੂੰ ਠੀਕ ਹੈ ਜੀ ਬਸ ਫਿਰ ਕੋਈ ਗੱਲ ਨੀ ਕੈਸ਼ ਓਨ ਡਿਲੀਵਰੀ ਕਰ ਦਾਂਗੇ ਹਾਂਜੀ ਅੱਜ ਕੁਝ ਹੋਰ ਵੀ ਸਪੈਸ਼ਲ ਸਵੀਟ ਡਿਸ਼ ਹੈ ਨਹੀਂ ਨਹੀਂ ਆਈਸਕ੍ਰੀਮ ਤਾਂ ਨਹੀਂ ਮੰਗਵਾਣੀ ਅਸੀਂ ਠੀਕ ਹੈ ਜੀ

ਨਹੀਂ ਨਹੀਂ ਰਬੜੀ ਵਗੈਰਾ ਵੀ ਨਹੀਂ ਚਲੋ ਕੋਈ ਗੱਲ ਨਹੀਂ ਤੁਸੀਂ ਰਸਮਲਾਈ ਭੇਜੋ ਫਿਰ ਦੇਖਦੇ ਆਗੇ ਠੀਕ ਹੈ ਥੋੜਾ ਜਿਹਾ ਜਲਦੀ ਆਰਡਰ ਕਰਵਾ ਦਿਓ ਸਾਡਾ ਠੀਕ ਹੈ ਜੀ ਓਕੇ